ਭਾਰਤ ਦੇਸ਼ ਦਾ ਇਤਿਹਾਸ ਇਹ ਹੈ ਕਿ ਭਾ ਸਾਡਾ ਭਾਰਤ ਦੇਸ਼ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਸੀਗਾ ਜੋ ਕਿ ਸਾਡੇ ਤੇ ਅੰਗਰੇਜ਼ ਬਹੁਤ ਹੀ ਜੁਲਮ ਕਰਦੇ ਸੀ ਸਾਡੇ ਲੋਕਾਂ ਦੇ ਉੱਤੇ ਬਹੁਤ ਹੀ ਅੱਤਿਆਚਾਰ ਕਰਦੇ ਸੀ ਅਤੇ ਇਹ ਅੰਦੋਲਨ ਇਸ ਲਈ ਚਲਾਇਆ ਗਿਆ ਤਾਂ ਕਿ ਸਾਡਾ ਦੇਸ਼ ਅਜ਼ਾਦ ਹੋ ਸਕੇ ਅਤੇ ਅੰਗਰੇਜ਼ਾਂ ਦੇ ਗ੍ਰਿਫਤ ਵਿੱਚੋਂ ਅਜ਼ਾਦ ਹੋ ਸਕੇ ਜਿਸ ਵਿੱਚ ਸਾਡੇ ਦੇਸ਼ ਦੇ ਬਹੁਤ ਹੀ ਹੋਣਹਾਰ ਲੋਕ ਜਿਹਦੇ ਜਿੱਦਾਂ ਕਿ ਮਹਾਤਮਾ ਗਾਂਧੀ ਜੀ ਚੰਦਰ ਸ਼ੇਖਰ ਅਜ਼ਾਦ ਭਗਤ ਸਿੰਘ ਸਰਦਾਰ ਪਟੇਲ ਮੰਗਲ ਸਿੰਘ ਇਹ ਸਾਰੇ ਲੋਕਾਂ ਨੇ ਸਾਡੇ ਦੇਸ਼ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ ਸਾਡਾ ਦੇਸ਼ ਉੱਨੀ ਸ ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਕੋ ਅਜ਼ਾਦ ਹੋ ਗਿਆ ਸੀ ਇਸ ਵਿੱਚ ਸਾਡੇ ਦੇਸ਼ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਗਿਆ ਜਿਸ ਵਿੱਚ ਪਾਕਿਸਤਾਨ ਅਤੇ ਭਾਰਤ ਜਿਸ ਵਿੱਚ ਅਸੀਂ ਰਹਿੰਦੇ ਹਾਂ